ਅੱਜ ਕੱਲ੍ਹ ਡੇਂਗੂ ਅਤੇ ਮਲੇਰੀਆ ਦਾ ਬੁਖਾਰ ਕਾਫੀ ਵੱਧ ਰਿਹਾ ਹੈ ਅਤੇ ਇਹ ਛੋਟੇ ਬੱਚਿਆਂ ਵਿੱਚ ਜ਼ਿਆਦਾ ਵੇਖਣ ਨੂੰ ਮਿਲਦਾ ਹੈ ਜਦੋਂ ਵੀ ਗਰਮੀਆਂ ਸਟਾਰਟ ਹੁੰਦੀਆਂ ਹਨ ਜਾਂ ਬਾਰਿਸ਼ਾਂ ਦਾ ਮੌਸਮ ਹੁੰਦਾ ਤਾਂ ਇਹ ਬਿਮਾਰ ਦੋਵੇਂ ਬੁਖਾਰ ਕਾਫੀ ਟਰੈਂਡ ਵਿੱਚ ਆ ਜਾਂਦੇ ਹਨ ਕਿਉਂਕਿ ਹਰ ਪੰਜਵੇਂ ਜਾਂ ਛਠੇ ਬੱਚੇ ਨੂੰ ਅੱਜ ਕੱਲ੍ਹ ਮਲੇਰੀਆ ਅਤੇ ਡੇਂਗੂ ਹੋ ਰਿਹਾ ਹੈ ਇਹਦੀ ਵਜ੍ਹਾ ਹੁੰਦੀ ਹੈ ਜਿਵੇਂ ਬੱਚੇ ਬਾਹਰ ਖੇਲਣ ਜਾਂਦੇ ਨੇ ਅਤੇ ਘਾਹ ਵਿੱਚ ਖੇਲਦੇ ਨੇ ਨੰਗੇ ਪੈਰ ਕਈ ਬੱਚੇ ਤਾਂ ਉਹਨਾਂ ਨੂੰ ਮੱਛਰ ਕੱਟ ਜਾਂਦਾ ਜਾਂ ਘਰ ਬੈਠੇ ਵੀ ਜਿੱਥੇ ਸੁਵਿਧਾ ਨਾ ਹੋਵੇ ਵਧੀਆ ਜਿੱਥੇ ਅਸੀਂ ਕੋਈ ਮੋਰਟੀਨ ਵਗੈਰਾ ਨਾ ਚਲਾਇਆ ਹੋਵੇ ਉੱਥੇ ਵੀ ਬੁਖਾਰ ਹੋ ਜਾਂਦਾ ਹੈ ਇਹਨੂੰ ਸਹੀ ਕਰਨ ਵਾਸਤੇ ਇੱਕ ਤਾਂ ਆਪਣੇ ਘਰ ਵਿੱਚ ਅਗਰ ਬੱਤੀਆਂ ਲਗਾਉਣੀਆਂ ਚਾਹੀਦੀਆਂ ਹਨ ਮੋਰਟੀਨ ਆਲਆਊਟ ਜਿਵੇਂ ਪ੍ਰੋਡਕਟ ਸਾਨੂੰ ਯੂਸ ਕਰਨੇ ਚਾਹੀੇਦੇ ਹਨ ਅਤੇ ਸਾਨੂੰ ਜ਼ਿਆਦਾ ਬਾਹਰ ਨਹੀਂ ਘੁੰਮਣਾ ਚਾਹੀਦਾ ਅਤੇ ਸਾਨੂੰ ਕਦੇ ਵੀ ਕੋਈ ਹੱਥ ਜਾਂ ਪੈਰ ਨੰਗੇ ਨਹੀਂ ਛੱਡਣੇ ਚਾਹੀਦੇ ਬਰਸਾਤਾਂ ਵਿੱਚ ਇਵੇਂ ਅਸੀਂ ਡੇਂਗੂ ਅਤੇ ਮਲੇਰੀਆ ਦੇ ਬੁਖਾਰਾਂ ਨਾਲ ਵਾਚਕ ਬਚ ਸਕਦੇ ਹਾਂ ਅਤੇ ਬਾਕੀਆਂ ਨੂੰ ਵੀ ਬਚਾ ਸਕਦੇ ਹਨ ਅਤੇ ਅੱਜ ਕੱਲ੍ਹ ਕਾਫੀ ਜਗ੍ਹਾ ਮੱਛਰ ਮਾਰਨ ਵਾਲੀ ਡੇਂਗੂ ਅਤੇ ਮੇਰ ਮੱਛਰ ਵਾਲੀਆਂ ਮਸ਼ੀਨਾਂ ਆਉਂਦੀਆਂ ਹਨ ਉਹ ਵੀ ਸਰਕਾਰ ਨੇ ਬਹੁਤ ਵਧੀਆ ਇਨੀਸ਼ੇਟਿਵ ਲਈ ਹੈ ਸਾਡੇ ਬੁਖਾਰਾਂ ਨੂੰ ਠੀਕ ਕਰਨ ਵਾਸਤੇ ਅਤੇ ਮੱਛਰ ਨੂੰ ਭਜਾਉਣ ਵਾਸਤੇ